ਵੈਸੇ ਤਾਂ ਨਵਜੰਮੇ ਬੱਚੇ ਲਈ ਉਸਦੇ ਪਹਿਲੇ ਸਾਲ ਦੇ ਦੌਰਾਨ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਪਰ ਇੱਕ ਬਹੁਤ ਹੀ ਮਹੱਤਵਪੂਰਨ ਰਸਮ ਜੋ ਕਿ ਨਾਮਕਰਣ ਦੀ ਰਸਮ ਹੈ ਤਾਂ ਉਹ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਕੀਤੀ ਜਾਂਦੀ ਹੈ ਤਾਂ ਇਸ ਰਸਮ ਦੇ ਵਿੱਚ ਬੱਚੇ ਦਾ ਨਾਮਕਰਣ ਕੀਤਾ ਜਾਂਦਾ ਹੈ ਅਤੇ ਵੱਖ ਵੱਖ ਧਰਮਾਂ ਦੇ ਵਿੱਚ ਵੱਖ ਵੱਖ ਤਰੀਕਿਆਂ ਦੇ ਨਾਲ ਇਸ ਰਸਮ ਨੂੰ ਕੀਤਾ ਜਾਂਦਾ ਹੈ ਜੇ ਮੈਂ ਸਿੱਖ ਧਰਮ ਦੀ ਗੱਲ ਕਰਾਂ ਤਾਂ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਅਤੇ ਹੁਕਮਨਾਮੇ ਦਾ ਜੋ ਪਹਿਲਾ ਅੱਖਰ ਹੁੰਦਾ ਹੈ ਉਸ ਅੱਖਰ ਦੇ ਅਨੁਸਾਰ ਹੀ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਬੱਚੇ ਦੇ ਜਨਮ ਦੇ ਸਮੇਂ ਜੋ ਗ੍ਰਹਿਆਂ ਜਾਂ ਨਕਸ਼ਤਰਾਂ ਦੀ ਸਥਿਤੀ ਹੁੰਦੀ ਹੈ ਉਸਦੇ ਅਨੁਸਾਰ ਕੁਛ ਅੱਖਰ ਹੁੰਦੇ ਹਨ ਅਤੇ ਉਹਨਾਂ ਅੱਖਰਾਂ ਦੇ ਵਿੱਚੋਂ ਹੀ ਬੱਚੇ ਦੇ ਨਾਮਕਰਣ ਦੇ ਲਈ ਕਿਸੇ ਇੱਕ ਅੱਖਰ ਦੀ ਚੋਣ ਕੀਤੀ ਜਾਂਦੀ ਹੈ